ਹਾਂਜੀ ਇੱਕ ਵਾਰੀ ਜਦੋਂ ਮੈਂ ਆਪਣੀ ਜਾਇਦਾਦ ਆਪਣੇ ਨਾਮ ਲਗਵਾਉਣੀ ਸੀ ਤਾਂ ਤਹਿਸੀਲ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉੱਥੇ ਉਸ ਟਾਈਮ ਲੋਕ ਬਿਨਾਂ ਪੈਸੇ ਤੋਂ ਕੰਮ ਹੀ ਨਹੀਂ ਕਰਦੇ ਸੀ ਉਸ ਵਕਤ ਮੌਕੇ ਦਾ ਅਫ਼ਸਰ ਸੀ ਉਹ ਵੀ ਬਹੁਤਾ ਚੰਗਾ ਨਹੀਂ ਸੀ ਉਸਨੇ ਬੜਾ ਤੰਗ ਕੀਤਾ ਪਰ ਅੱਜ ਦੇ ਸਮੇਂ ਵਿੱਚ ਪ੍ਰਸ਼ਾਸਨ ਦੇ ਇਹਨਾਂ ਅਦਾਰਿਆਂ ਉੱਤੇ ਬਹੁਤ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ ਤਾਂ ਜੋ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਆਪਣੇ ਕੰਮਾਂ ਦੇ ਲਈ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ